ਮੋਹਾਲੀ ਜਿਹੜਾ ਜ਼ਿਲ੍ਹਾ ਹੈ ਇਸਨੂੰ ਬਣੇ ਨੂੰ ਜ਼ਿਆਦਾ ਦੇਰ ਨਈ ਹੋਈ ਮੋਹਾਲੀ ਜਿਹੜਾ ਜ਼ਿਲ੍ਹਾ ਹੈ ਇਹ ਫਤਿਹਗੜ੍ਹ ਸਾਹਿਬ ਰੋਪੜ ਅਤੇ ਪਟਿਆਲੇ ਦੇ ਕੁਝ ਪਿੰਡਾਂ ਨੂੰ ਲੈ ਕੇ ਬਣਿਆ ਹੋਇਆ ਇਸ ਕਰਕੇ ਇਨਾਂ ਪਿੰਡਾਂ ਦੇ ਲੋਕਾਂ ਦਾ ਹੀ ਇੱਥੇ ਵੱਸ ਹੈ ਇਹ ਲੋਕ ਆਪਣੇ ਸੱਭਿਆਚਾਰ ਨੂੰ ਬਹੁਤ ਪਿਆਰ ਕਰਦੇ ਨੇ ਅਤੇ ਭਾਸ਼ਾ ਵੀ ਇਹ ਪੰਜਾਬੀ ਬੋਲ ਕੇ ਕੂੜ ਪੰਜਾਬੀ ਬੋਲ ਕੇ ਪੁਆਧੀ ਬੋਲ ਕੇ ਖੁਸ਼ ਹੁੰਦੇ ਨੇ ਇਸ ਮੋਹਾਲੀ ਜ਼ਿਲ੍ਹੇ ਦੇ ਵਿੱਚ ਦੋ ਤਿੰਨ ਧਾਰਮਿਕ ਏ ਅਸਥਾਨ ਇਤਿਹਾਸਕ ਨੇ ਪਰ ਇੱਥੇ ਜਿੰਨੇ ਵੀ ਲੋਕ ਰਹਿੰਦੇ ਨੇ ਭਾਵੇਂ ਉਹ ਕਿਸੇ ਵੀ ਧਰਮ ਦੇ ਨਾਲ਼ ਸੰਬੰਧਿਤ ਨੇ ਇੱਕ ਦੂਜੇ ਦੇ ਧਾਰ ਧਰਮ ਨੂੰ ਪਿਆਰ ਵੀ ਕਰਦੇ ਨੇ ਅਤੇ ਹਰੇਕ ਸਮਾਗਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ